ਆਪਣੇ ਸਮਾਜ ਵਿੱਚ ਖੇਡਾਂ ਖੇਡਣ ਦੇ ਮਹੱਤਵ ਬਾਰੇ ਲੋਕਾਂ ਦਾ ਰਾ ਲੋਕਾਂ ਦਾ ਰਾਏ ਹਨ ਕਿ ਬੱਚਿਆਂ ਨੂੰ ਖੇਡ ਖੇਡ ਕੇ ਬਹੁਤ ਬਿਹਤਰ ਸਰੀਰ ਅਤੇ ਬਿਮਾਰ ਵੀ ਨਹੀਂ ਹੁੰਦੇ ਉਹ ਅਤੇ ਉਨ ਤੰਦਰੁਸਤ ਵੀ ਰਹਿੰਦੇ ਹਨ ਔਰ ਉਹ ਉਹਨਾਂ ਦਾ ਦਿਮਾਗ ਵੀ ਬਹੁਤ ਵਧੀਆ ਚਲਦਾ ਹੈ ਔਰ ਪੜ੍ਹਾਈ 'ਚ ਦਿਮਾਗ ਲੋਕ ਜਿੰਨਾ ਪੜ੍ਹਾਈ 'ਤੇ ਧਿਆਨ ਦਿੰਦੇ ਹਨ ਉਹਨਾਂ ਨੂੰ ਕ ਕਹਿਣਾ ਚਾਹੀਦਾ ਹੈ ਕਿ ਖੇਡਾਂ ਚ ਵੀ ਧਿਆਨ ਦਿਉ ਕਿਉਂਕਿ ਖੇਡਾਂ 'ਚ ਲੋ ਉਹਨਾਂ ਦਾ ਸਰੀਰ ਵੱਧਦਾ ਹੈ ਅਤੇ ਲੋਕ ਬਿਮਾਰ ਵੀ ਨਹੀਂ ਹੁੰਦੇ ਜ਼ਿਆਦਾ ਅਤੇ ਗਲਤ ਕੰਮਾਂ 'ਚ ਨਹੀਂ ਪੈਂਦੇ ਅਤ ਨ ਨਸ਼ਿਆਂ 'ਚ ਨਸ਼ਾ ਵੀ ਨਹੀਂ ਕਰਦੇ ਉਹ ਅਤੇ ਆਪਣੇ ਜਿੰਨਾ ਮਰਜ਼ੀ ਉਹਨਾਂ ਨੇ ਜੀਵਨ ਲਾਈਫ ਮੇ ਜਿੱਥੇ ਜਾਣਾ ਹੁੰਦਾ ਉੱਥੇ ਉਹ ਪੁੱਜ ਜਾਂਦੇ ਹਨ ਔਰ ਦੂਸਰੇ ਪਿੰਡਾਂ ਦੇ ਬੱਚਿਆਂ ਵੀ ਆ ਕੇ ਸਾਡੇ ਮੈ ਗਰਾਊਂਡ 'ਚ ਖੇਡਦੇ ਹਨ ਅਸੀਂ ਅਸੀਂ ਅਸੀਂ ਆਪਣੇ ਪਿੰਡ 'ਚ ਬਹੁਤ ਵਧੀਆ ਬੜਾ ਗਰਾਊਂਡ ਬਣਾਇਆ ਹੈ ਬਣਾਇਆ ਬਣਾਇਆ ਹੋਇਆ ਹੈ ਉਥੇ ਫੈਸਲਿਟੀ ਵੀ ਦਿੱਤੀਆਂ ਗਈਆਂ ਹਨ ਬੱਚਿਆਂ ਨੂੰ ਫੁੱਟਬੋਲ ਦੇ ਹਨ ਅਤੇ ਹਾਂ ਸਾਡੇ ਗਰਾਊਂਡ 'ਚ ਖੇਡਣ ਵਾਲੀ ਗੇਮ ਹਨ ਫੁੱਟਬੋਲ ਹੋਕੀ ਬੈਡਮਿੰਟਨ ਕਬੱਡੀ ਖੋ ਖੋ ਆਦਿ ਹਨ ਲੇਡੀ ਲੇਡੀਜ਼ ਵੀ ਲੇਡੀਜ਼ ਵੀ ਆਉਂਦੇ ਹਨ ਖੇਡਣ ਖੇਡਣ ਲਈ ਅਤੇ ਕੁੜੀਆਂ ਵੀ ਆਉਂਦੇ ਹਨ ਆਉਂਦੇ ਹਨ ਖੇਡਣ ਲਈ